ਬਾਲੀਵੁੱਡ ਅਤੇ ਟਾਲੀਵੁੱਡ ਨੇ ਸਾਨੂੰ ਫੈਸ਼ਨੇਵਲ ਬਣਾ ਦਿੱਤਾ ਹੈ ਅਸੀਂ ਜੋ ਟੀ ਵੀ 'ਤੇ ਵੇਖਦੇ ਹਾਂ ਉਹੀ ਜਿਹਾ ਪਹਿਰਾਵਾ ਪਾ ਕੇ ਉਹੋ ਜਿਹੇ ਦਿਖਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਸਸਿ ਪੀੜ੍ਹੀ ਸਿਨੇਮਾ ਤੋਂ ਇੰਨੀ ਪ੍ਰਭਾਵਿਤ ਹੋ ਚੁੱਕੀ ਹੈ ਕਿ ਅੱਧ ਨੰਗੀ ਸਰੀਰ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕਰਦੀ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲ ਕੇ ਵਿਦੇਸ਼ੀ ਪਹਿਰਾਵੇ ਵੱਲ ਬਹੁਤ ਛੇਤੀ ਝੁੱਕ ਜਾਂਦੇ ਹਾਂ ਅੱਜ ਅੱਜ ਕੱਲ੍ਹ ਅਸੀਂ ਫਿਲਮਾਂ ਨੂੰ ਵੇਖ ਵੇਖ ਕੇ ਉਜੜਨ 'ਤੇ ਆ ਗਏ ਹਾਂ ਕਿਉਂਕਿ ਵਾਲਾਂ ਦੇ ਸਟੈਲ ਤੋਂ ਲੈ ਕੇ ਕੱਪੜਿਆਂ ਦੇ ਵੱਖਰੇ ਵੱਖਰੇ ਫੈਸ਼ਨਾਂ ਗਹਿਣਿਆਂ 'ਤੇ ਪਰਾ ਦੁਨੀਆ ਪਈ ਪੱਟੀ ਪਈ ਪੱਟੀ ਪਈ ਸੀ ਪਰ ਹੁਣ ਤਰ੍ਹਾਂ ਤਰ੍ਹਾਂ ਮ ਮੂੰਹ 'ਤੇ ਲਾਉਣ ਵਾਲੀਆਂ ਕਰੀਮਾਂ ਭਰਵੱਟਿਆਂ ਨੂੰ ਕਾਲੇ ਕਰਨ ਲਈ ਕਾਲੀ ਪੈਨਸਲ ਵਾਲਾਂ ਨੂੰ ਸਰੀਰ ਤੋਂ ਉਡਾਉਣ ਲਈ ਵੈਕਸ ਪਤਾ ਨਹੀਂ ਕੀ ਕੀ ਸਭ ਬਾਲੀਵੁੱਡ ਦੀ ਦੇਣ ਹੈ ਕੁੜੀਆਂ ਆਪਣੇ ਵਿਆਹ ਵਾਲੇ ਦਿਨ ਪੰਜਾਹ ਪੰਜਾਹ ਹਜ਼ਾਰ ਰੁਪਏ ਬਿਊਟੀ ਪਾਰਲਰਾਂ ਵਾਲੀਆਂ ਕੋਲ ਖ਼ਰਾਬ ਕਰਦੀਆਂ ਹਨ ਅਤੇ ਕਈ ਹਜ਼ਾਰਾਂ ਦੇ ਲਹਿੰਗੇ ਬਾਲੀਵੁੱਡ ਐਕਟਰ ਵਰਗ ਵਰਗੇ ਸਵ ਸਟੈਲ ਵਿੱਚ ਬਣਵਾਉਂਦੀਆਂ ਹਨ ਹੁਣ ਨਹੀਂ ਮੈਂ ਬਹੁਤ ਸਿੱਧੀ ਸਾਦੀ ਪੰਜਾਬੀ ਜੱਟੀ ਹਾਂ ਮੈਨੂੰ ਇਸ ਤਰ੍ਹਾਂ ਕਰਨਾ ਪਸੰਦ ਨਹੀਂ